ਤਕਨਾਲੋਜੀ ਨੇ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਵੱਡੇ ਪੱਧਰ ਤੱਕ ਪ੍ਰਭਾਵਿਤ ਕੀਤਾ ਹੈ ਖਾਸ ਤੌਰ 'ਤੇ ਕੋਵਿਡ ਉੱਨੀ ਦੇ ਚੱਲਦਿਆਂ ਇਸ ਦੀ ਵਰਤੋਂ ਵਿੱਚ ਚੋਖਾ ਇਜਾਫਾ ਹੋਇਆ ਹੈ ਪਰੰਤੂ ਇਸ ਦੇ ਨਾਲ ਹੀ ਜੋ ਕਲਾਸ ਦੇ ਅੰਦਰ ਜੋ ਪੜ੍ਹਾਈ ਹੈ ਅਧਿਆਪਕ ਦੁਆਰਾ ਕੀਤੀ ਜਾਂਦੀ ਹੈ ਉਹਨੂੰ ਵੀ ਹੋਰ ਅਗਲੇ ਪੱਧਰ ਤੱਕ ਲੈ ਕੇ ਜਾਣ ਦੇ ਵਿੱਚ ਭੂਮਿਕਾ ਨਿਭਾਈ ਜਾ ਰਹੀ ਹੈ ਚਾਹੇ ਉਹ ਕੰਪਿਊਟਰ ਦੀ ਵਰਤੋਂ ਕਰਕੇ ਵੱਖ ਵੱਖ ਜੋ ਸੋਫਟਵੇਅਰ ਨੇ ਉਹਨਾਂ ਦੀ ਵਰਤੋਂ ਨਾਲ ਵਿਦਿਆਰਥੀਆਂ ਦੀ ਭਾਵੇਂ ਉਹ ਸਕੂਲ ਦੇ ਪੱਧਰ 'ਤੇ ਹੋਣ ਭਾਵੇਂ ਉਹ ਕਾਲਜ ਦੇ ਪੱਧਰ 'ਤੇ ਹੋਣ ਯੂਨੀਵਰਸਿਟੀ ਦੇ ਪੱਧਰ 'ਤੇ ਹੋਣ ਉਹਨਾਂ ਦੀ ਪੜ੍ਹਾਈ ਨੂੰ ਉਹਨਾਂ ਦੀ ਸਿਖਲਾਈ ਨੂੰ ਅਸਰਦਾਰ ਬਣਾਉਣ ਦੇ ਵਿੱਚ ਇਹ ਤਕਨਾਲੋਜੀ ਜਿਹੜੀ ਹੈ ਉਹ ਆਪਣਾ ਰੋਲ ਆਪਣੀ ਭੂਮਿਕਾ ਨਿਭਾ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਵਰਤੋਂ ਕਰਕੇ ਇਹ ਸਾਰੇ ਸਿੱਖਿਆ ਪ੍ਰਣਾਲੀ ਦੇ ਕਾਰਜਾਂ ਨੂੰ ਹੋਰ ਅਸਰਦਾਰ ਬਣਾਉਣ ਦੀਆਂ ਬਹੁਤ ਵੱਡੀਆਂ ਅਤੇ ਡੂੰਘੀਆਂ ਸੰਭਾਵਨਾਵਾਂ ਹਨ